ਹੈਲੋ ਹਾਂਜੀ ਹਾਂ ਮੈਂ ਜੀ ਕੀ ਨਾਮ ਥੋੜਾ ਦੁੱਧ ਬਾਰੇ ਪਤਾ ਕਰਨਾ ਸੀ ਤੁਸੀਂ ਚੋਧਰੀ ਡੈਰੀ ਤੋਂ ਬੋਲ ਰਹੇ ਓ ਹਾਂਜੀ ਹਾਂਜੀ ਜੀ ਕੀ ਨਾਮ ਨਾ ਸਾਡੇ ਹੈਗਾ ਐ ਫ਼ੰਕਸ਼ਨ ਘਰੇ ਤੇ ਸਾਨੂੰ ਕੀ ਨਾਮ ਚਾਈਦਾ ਸੀ ਦੁੱਧ ਜੀ ਆਹੀ ਕੋਈ ਪੱਚੀ ਤੀਹ ਕਿਲੋ ਦੁੱਧ ਚਾਈਦਾ ਹੋਊਗਾ ਹਾਂਜੀ ਤੇ ਕੀ ਨਾਮ ਕਿਵੇਂ ਵਿਰਾਇਟੀ ਵਿਰੂਇਟੀ ਕਿਵੇਂ ਕੀ ਰੱਖਦੇ ਓ ਅੱਛਾ ਹਾਂਜੀ ਓਹੀ ਓਹੀ ਪੁੱਛਣਾ ਐ ਹਾਂਜੀ ਤੇ ਕੀ ਨਾਮ ਅੱਛਾ ਤੇ ਕਿਵੇਂ ਕੀ ਪ੍ਰਾਈਜ ਐ ਵੇਰਕਾ ਵਾਲੇ ਦਾ ਇੱਕ ਪੈਕਟ ਦਾ ਅੱਛਾ ਜੀ ਤੇ ਅਮੁੱਲ ਵਾਲਿਆਂ ਦਾ ਅੱਛਾ ਜੀ ਹਾਂਜੀ ਇੱਕ ਵਰੀ ਤਾਂ ਹਲਵਾਈ ਨੇ ਸਾਨੂੰ ਦੁੱਧ ਕਿਹਾ ਐ ਫੇਰ ਇੱਕ ਵਰੀ ਅਸੀਂ ਪਨੀਰ ਦਾ ਵੀ ਪੁੱਛਾਂਗੇ ਲਿਸਟ ਬਨਵਾਲਾਂਗੇ ਸਾਰੀ ਤੇ ਹਾਂਜੀ ਤੇ ਫੇਰ ਅਸੀਂ ਕਰਾਂਗੇ ਓਡਰ ਇੱਕ ਵਰੀ ਮੈਂ ਦੁੱਧ ਦਾ ਰੇਟ ਪੁੱਛਣਾ ਸੀਗਾ ਵਈ ਕਿਵੇਂ ਕੀ ਸਾਬ ਐ ਦੁੱਧ ਦਾ ਹਾਂਜੀ ਤੇ ਵੈਸੇ ਖੁੱਲਾ ਦੁੱਧ ਲੈਣਾ ਹੋਵੇ ਤਾਂ ਉਨ ਦਾ ਕੀ ਪ੍ਰਾਈਜ ਐ ਬਿਨ੍ਹਾਂ ਪੈਕੇਟ ਵਾਲਾ ਅੱਛਾ ਅਲੱਗ ਅਲੱਗ ਵਿਰਾਇਟੀ ਐ ਅੱਛਾ ਜੀ ਤੇ ਕਿਵੇਂ ਡਿਲਿਵਰੀ ਵਗੈਰਾ ਤੁਸੀਂ ਫੇਰ

ਅੱਛਾ ਠੀਕ ਐ ਫੇਰ ਕੀ ਨਾਮ ਸਾਨੂੰ ਚਾਰ ਕ ਦਿਨ ਬਾਅਦ ਚਾਈਦਾ ਹੋਏਗਾ ਦੁੱਧ ਵਧੀਆ ਫਰੈਸ਼ ਦੁੱਧ ਆਣਾ ਚਾਈਦਾ ਹੂੰ ਹਾਂਜੀ ਅੱਛਾ ਜੀ ਠੀਕ ਐ ਤੇ ਕੀ ਨਾਮ ਪਨੀਰ ਦਾ ਵੀ ਫੇਰ ਦੱਸ ਈ ਦਓ ਰੇਟ ਵੈਸੇ ਅਸੀਂ ਪੁੱਛਲਾਂਗੇ ਮਤਲਬ ਜਿਹੜੇ ਵੀ ਅਸੀਂ ਹਲਵਾਈ ਵਗੈਰਾ ਬੁੱਕ ਕੀਤੇ ਐ ਅੱਛਾ ਜੀ ਪਨੀਰ ਕੋਈ ਦੇਖੋ ਹੁਣ ਫੇਰ ਅਸੀਂ ਕੱਠਾ ਲਵਾਂਗੇ ਤਾਂ ਥੋੜਾ ਜਿਆ ਡਿਸਕਾਊਂਟ

ਠੀਕ ਐ ਹਾਂਜੀ ਠੀਕ ਐ ਚਲੋ ਫੇਰ ਮੈਂ ਦੁੱਧ ਦਾ ਤਾਂ ਜਿਵੇਂ ਤੁਸੀਂ ਮੈਂ ਤੁਹਾਨੂੰ ਲਿਖਵਾ ਦਊਂਗੀ ਤੇ ਪਨੀਰ ਦਾ ਪੁੱਛਲਾਂਗੇ ਪੱਚੀ ਤੀਹ ਤੀਹ ਤੀਹ ਕਿਲੋ ਦੁੱਧ ਲਵਾਂਗੇ ਅਸੀਂ ਹਾਂਜੀ ਮੱਝ ਦਾ ਲੈਣਾ ਹਾਂਜੀ ਠੀਕ ਐ ਜੀ